ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਦਿਨਾਂ ਵਿੱਚ ਸਾਡੇ ਇੱਥੇ ਪੰਜਾਬ ਦੇ ਵਿੱਚ ਬਹੁਤ ਠੰਡ ਪਈ ਠੰਡ ਪਈ ਅਤੇ ਮੈਂ ਸੋਚਿਆ ਕਿ ਯਾਰ ਕੋਈ ਜੈਕਟ ਮੰਗਵਾ ਲਿਤੀ ਜਾਵੇ ਫਿਰ ਮੈਂ ਔਨਲਾਈਨ ਸ ਪਹਿਲੇ ਤਾਂ ਮੈਂ ਬਜ਼ਾਰ ਘੁੰਮਣ ਗਿਆ ਪਰ ਮੈਨੂੰ ਕੋਈ ਜੈਕਟ ਮੇਰੇ ਮਤਲਬ ਦੀ ਮਿਲੀ ਨਹੀਂ ਮੈਂ ਫਿਰ ਔਨਲਾਈਨ ਸਰਚ ਕੀਤਾ ਅਤੇ ਇੱਕ ਬੜੀ ਵਧੀਆ ਡੈਨਮ ਦੀ ਜੈਕਟ ਮੈਨੂੰ ਮਿਲੀ ਮੈਂ ਉਹਦੀ ਸਰਚ ਕਰਕੇ ਦੇਖਿਆ ਕਿ ਪ੍ਰਾਈਜ਼ ਉਹਦੀ ਪੰਜ ਹਜ਼ਾਰ ਰੁਪਿਆ ਹੈਗੀ ਸੀ ਲੇਕਿਨ ਉਹ ਡਿਸਕਾਉਂਟ ਕਰਕੇ ਮੈਨੂੰ ਪੱਚੀ ਸੌ ਦੀ ਪਈ ਔਰ ਮੈਂ ਵੋ ਔਡਰ ਕਰ ਤੀ ਅਤੇ ਉਹ ਆ ਗਈ ਕੁਝ ਦਿਨਾਂ 'ਚ ਅਤੇ ਮੈਨੂੰ ਡਿਲੀਵਰੀ ਬੋਆਏ ਨੇ ਦਿੱਤੀ ਉਹ ਬੜੇ ਵਧੀਆ ਡਿਲੀਵਰੀ ਕਰਕੇ ਗਿਆ ਮੈਂ ਉਹ ਜੈਕਟ ਕੁਝ ਪਾਈ ਅਤੇ ਉਹ ਪਾ ਕੇ ਮੈਂ ਸਾਰਾ ਸੀਜ਼ਨ ਆਪਣਾ ਉਹਦੇ ਨਾਲ ਹੀ ਕੱਟਿਆ ਔਰ ਮੈਨੂੰ ਬਿਲਕੁਲ ਵੀ ਆਉਣ ਜਾਣ ਲੱਗਿਆ ਠੰਡ ਨਹੀਂ ਲੱਗੀ ਅਤੇ ਜੈਕਟ ਬਹੁਤ ਹੀ ਵਧੀਆ ਸੀ ਪਰ ਮੈਂ ਸੋਚਿਆ ਹੁਣ ਅੱਗੋਂ ਤੋਂ ਜਿਹਦੀ ਕੋਈ ਹੋਰ ਵੀ ਪ੍ਰੋਡਕਟ ਹੋਇਆ ਤਾਂ ਮੈਂ ਉਹਨੂੰ ਔਨਲਾਈਨ ਜ਼ਰੂਰ ਸੇਲ ਪਰਚੇਸ ਕਰਿਆ ਕਰਾਂਗਾ